ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਮੈਂ ਰਮਨਦੀਪ ਕੌਰ ਬੋਲ ਰਹੀ ਹੈਗੀ ਬਠਿੰਡਾ ਤੋਂ ਹਾਂਜੀ ਜੋ ਕਿ ਮੈਂ ਐਮਾਜੋਂਨ ਤੋਂ ਫੋਨ ਔਡਰ ਕੀਤਾ ਸੀਗਾ ਸੈਮਸੰਗ ਕੰਪਨੀ ਦਾ ਜੋ ਕਿ ਮੈਂ ਪੰਜ ਦਿਨ ਪਹਿਲਾਂ ਆਡਰ ਕੀਤਾ ਸੀਗਾ ਤਾਂ ਉਹ ਛੇਵੇਂ ਦਿਨ ਮੈਨੂੰ ਮਿਲ ਚੁੱਕਿਆ ਜੀ ਫੋਨ ਫੋਨ ਦੀ ਜਿਹੜੇ ਕਿ ਆਪਾਂ ਬਾਜ਼ਾਰੂ ਰੇਟਾਂ ਤੋਂ ਜਿਹੜੇ ਕਿ ਆਪਾਂ ਨੂੰ ਜੋ ਫੋਨ ਹੈਗਾ ਜਿਹੜਾ ਆਪਾਂ ਬਾਜ਼ਾਰ ਰੇਟਾਂ 'ਤੇ ਲੈਂਦੇ ਹੈਗੇ ਹਾਂ ਉਹ ਉੱਥੇ ਆਪਾਂ ਨੂੰ ਦਸ ਹਜ਼ਾਰ ਦਾ ਮਿਲਦਾ ਹੈਗਾ ਕਿਸੇ ਵੀ ਕੰਪਨੀ ਅਤੇ ਮੈਨੂੰ ਐਮਾਜੋਂਨ ਦੇ ਉੱਪਰੋਂ ਜਿਹੜਾ ਫੋਨ ਆਡਰ ਕੀਤਾ ਹੋਇਆ ਮਿਲਿਆ ਗਾ ਬਹੁਤ ਹੀ ਵਧੀਆ ਫੋਨ ਹੈ ਉਹ ਕਿਉਂਕਿ ਮੈਂ ਚਲਾ ਕੇ ਦੇਖਿਆ ਮੈਨੂੰ ਫੰਕਸ਼ਨ ਵੀ ਬਹੁਤ ਵਧੀਆ ਲੱਗੇ ਜਿਹੜੇ ਕਿ ਆਪਾਂ ਨੂੰ ਵੈਸੇ ਤੌਰ 'ਤੇ ਆਪਾਂ ਜਾਣੀਏ ਤਾਂ ਆਪਾਂ ਨੂੰ ਜਿਹੜੇ ਵੈਸੇ ਸ਼ੋਪਸ 'ਚ ਹੁੰਦੇ ਨੇ ਉੱਥੋਂ ਵਧੀਆ ਮਿਲਦੇ ਨੇ ਫੋਨ ਐਮਾਜੋਂਨ ਤੋਂ ਸੰਭਵ ਨਹੀਂ ਹੁੰਦਾ ਪਰ ਫਿਰ ਵੀ ਮੈਨੂੰ ਬਹੁਤ ਸੋਹਣਾ ਜਿਹੜਾ ਕਿ ਫੋਨ ਹੈ ਮਿਲਿਆ ਹੈਗਾ ਗਾ ਬਹੁਤ ਵਧੀਆ ਫੋਨ ਚੱਲਦਾ ਹੈਗਾ ਜੀ ਮੇਰਾ ਔਰ ਸਭ ਤੋਂ ਬੈਸਟ ਚੀਜ਼ ਇਹ ਲੱਗੀ ਕਿ ਆਪਾਂ ਨੂੰ ਐਮਾਜੋਂਨ ਤੋਂ ਵਧੀਆ ਜਿਹੜਾ ਕਿ ਫੋਨ ਪ੍ਰਾਪਤ ਹੋਇਆ ਹੈਗਾ ਹਾਂਜੀ ਤਾਂ ਮੈਂ ਬਹੁਤ ਧੰਨਵਾਦ ਕਰਦੀ ਐਮਾਜੋਂਨ ਦਾ ਕਿ ਮੈਨੂੰ ਫੋਨ ਦੀ ਕੁਆਲਿਟੀ ਐਡੀ ਜ਼ਿਆਦਾ ਵਧੀਆ ਮਿਲੀ ਵੈਸੇ ਵੀ